ਰੂਪਨਗਰ ਜ਼ਿਲ੍ਹੇ ਵਿੱਚ ਮੁੱਖ ਉਦਯੋਗ ਅਤੇ ਆਰਥਿਕ ਚਾਲਕ ਬਹੁਤ ਸਾਰੇ ਹਨ ਜਿਵੇਂ ਕਿ ਖੇਤੀਬਾੜੀ ਖੇਤੀਬਾੜੀ ਦੇ ਵਿੱਚ ਸਾਡੇ ਜ਼ਿਲ੍ਹੇ ਵਿੱਚ ਕਣਕ ਬਾਜਰਾ ਮੱਕੀ ਝੋਨਾ ਇਹ ਸਾਰੀ ਚੀਜ਼ਾਂ ਦੀ ਖੇਤੀ ਕੀਤੀ ਜਾਂਦੀ ਆ ਨਿਰਮਾਣ ਖੇਤਰ ਦੇ ਵਿੱਚ ਇੱਥੇ ਦੋ ਫੈਕਟਰੀਆਂ ਹਨ ਜਿਵੇਂ ਕਿ ਚੀਮਾ ਬੋਇਲਰ ਸਵਰਾਜ ਮਾਜਦਾ ਅਤੇ ਸੇਵਾ ਕੇਂਦਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਲੋਕਾਂ ਲਈ ਸਾਂਝ ਕੇਂਦਰ ਸੇਵਾ ਕੇਂਦਰ ਜਿਹੜੇ ਖੋਲ੍ਹੇ ਗਏ ਆ ਜਿੱਥੇ ਕਿ ਲੋਕ ਜਾ ਕੇ ਆਪਣਾ ਸ ਸਰਕਾਰੀ ਕੰਮ ਕਰਵਾਉਂਦੇ ਆ ਅਤੇ ਹੋਰ ਬਹੁਤ ਸਾਰੇ ਕੋਰਟ ਆ ਜਿੱਥੇ ਕਿ ਲੋਕ ਆਪਣੇ ਹੋਰ ਜਿਹੜੇ ਆਰਥਿਕ ਕੇਸ ਵਗੈਰਾ ਲੜਦੇ ਆ